ਮੈਂ ਪਿਛਲੇ ਮਹੀਨਾ ਹੀ ਆਪਣੇ ਪੰਜਾਬ ਦੇ ਨਾਲ ਲੱਗਦੇ ਸ਼ਿਮਲੇ ਸ਼ਹਿਰ ਦੇ ਵਿੱਚ ਗਿਆ ਸੀ ਘੁੰਮਣ ਲਈ ਸਰਦੀਆਂ ਦੇ ਟਾਈਮ ਵਿੱਚ ਸ਼ਿਮਲਾ ਵਿੱਚ ਬਹੁਤ ਚੰਗਾ ਮੌਸਮ ਹੁੰਦਾ ਹੈ ਅਤੇ ਬਹੁਤ ਸਾਰੇ ਟੂਰਿਸਟ ਵੀ ਆਉਂਦੇ ਹਨ ਉੱਥੇ ਬਰਫ ਪੈਂਦੀ ਹੈ ਅਸੀਂ ਜਾਂਦੇ ਜਾਂਦੇ ਰਾਸਤੇ ਵਿੱਚ ਹੀ ਬਹੁਤ ਵਧੀਆ ਵਧੀਆ ਚੀਜ਼ਾਂ ਦੇਖੀਆਂ ਬਹੁਤ ਨਵੇਂ ਨਵੇਂ ਲੋਕਾਂ ਨਾਲ ਵੀ ਮਿਲੇ ਇਕਦਮ ਵਧੀਆ ਮਾਹੌਲ ਸ਼ਿਮਲੇ ਦੇ ਪਹਾੜਾਂ ਦੇ ਉੱਤੇ ਵਧੀਆ ਹਵਾਵਾਂ ਚੱਲ ਰਹੀਆਂ ਸੀਗੀਆਂ ਇਕਦਮ ਵਧੀਆ ਸੂਰਜ ਐਨ ਵਧੀਆ ਧੁੱਪ ਦੇ ਰਿਹਾ ਸੀਗਾ ਉੱਥੇ ਖਾਣ ਪੀਣ ਦਾ ਇਕਦਮ ਵਧੀਆ ਬੰਦੋਬਸਤ ਸੀਗਾ ਅਤੇ ਇਕਦਮ ਉਹ ਜਗ੍ਹਾ ਜੰਨਤ ਤੋਂ ਘੱਟ ਨਹੀਂ ਸੀ ਸ਼ਿਮਲੇ ਵਿੱਚ ਜਾਣ ਨਾਲ ਆਪਣੇ ਮਨ ਦੀ ਸ਼ਾਂਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਲੋਕ ਜਾ ਕੇ ਉੱਥੇ ਬਹੁਤ ਜ਼ਿਆਦਾ ਇੰਨਜੋਏ ਵੀ ਕਰ ਸਕਦੇ ਹਨ